ਭੰਗੜਾ ਪੰਜਾਬ ਦੀ ਸ਼ਾਨ ਹੈ ਜਿਵੇਂ ਕੁੜੀਆਂ ਅਤੇ ਮੁੰਡੇ ਇਕੱਠੇ ਭੰਗੜਾ ਪਾਉਂਦੇ ਹਨ ਜਿਵੇਂ ਕਿ ਪੰਜਾਬੀ ਸੂਟ ਮੁੰਡੇ ਕੁੜਤਾ ਪਜਾਮਾ ਪਾਉਂਦੇ ਹਨ ਜੁੱਤੀ ਪਾਉਂਦੇ ਆ ਪਰਾ ਕੁੜੀਆਂ ਗੁੱਤ 'ਚ ਪਰਾਂਦਾ ਪਾਉਂਦੀਆਂ ਹਨ ਅਤੇ ਮੁੰਡੇ ਉਹ ਪਾਉਂਦੇ ਪੰਜਾਬੀ ਜੁੱਤੀ ਭੰਗੜਾ ਗੋਲ ਗੋਲ ਘੁੰਮ ਕੇ ਭੰਗੜਾ ਪਾਉਂਦੇ ਹਨ ਮੁੰਡੇ ਕੁੜੀਆਂ ਇਕੱਠੇ ਹੀ ਗੋਲ ਗੋਲ ਘੁੰਮ ਕੇ ਪ੍ਰਦਰਸ਼ਨ ਕਰਦੇ ਹਨ ਭੰਗੜੇ ਦਾ ਫਿਰ ਇਹ ਵਿਆਹ ਸ਼ਾਦੀਆਂ ਸਕੂਲਾਂ ਕਾਲਜਾਂ ਵਿੱਚ ਫ ਫੰਕਸ਼ਨ 'ਤੇ ਗਿਧ ਭੰਗੜਾ ਪਾਇਆ ਜਾਂਦਾ ਹੈ ਆਹ ਸੱਭਿਆਚਾਰ ਸੱਭਿਆਚਾਰ ਜਸ਼ਨ ਹਰ ਤਿਉਹਾਰ ਦ ਦਿਵਾਲੀ ਲੋਹੜੀ ਨੂੰ ਫੰਕਸ਼ਨ ਭੰਗੜਾ ਪਾਉਂਦੇ ਹਨ